ਸਰਕਾਰੀ ਨੌਕਰੀ ਅਤੇ ਆਪਣੇ ਕਾੜੋਬਾੜ ਵਿੱਚ ਬਹੁਤ ਫਰਕ ਹੁੰਦਾ ਹੈ ਇਹ ਫਰਕ ਤਾਂ ਬੰਦੇ ਦੀ ਸੋਚ ਉਹਦੀਆਂ ਜ਼ਰੂਰਤਾਂ ਅਤੇ ਉਹਦੀ ਕਾਬਲੀਅਤ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਮੈਂ ਤੁਹਾਨੂੰ ਇਹ ਦੋਨਾਂ ਦਾ ਮੁੱਖ ਤੌਰ 'ਤੇ ਅਨਸਰ ਤੋ ਮੁੱਖ ਤੌਰ 'ਤੇ ਤੁਹਾਨੂੰ ਸਮਝਾ ਦਿੰਦਾ ਹਾਂ ਦੋਨਾਂ ਦਾ ਫਰਕ ਕੀ ਹੈ ਫਿਰ ਮੈਂ ਦੱਸਦਾ ਹਾਂ ਕਿ ਮੈਂ ਕਿਹੜੀ ਕੀ ਚੁਣਾਂਗਾ ਸਰਕਾਰੀ ਨੌਕਰੀ ਜਾਂ ਆਪਣਾ ਕਾੜੋਬਾੜ ਪਹਿਲਾਂ ਤਾਂ ਸਰਕਾਰੀ ਨੌਕਰੀ ਵਿੱਚ ਤੁਹਾਨੂੰ ਇੱਕ ਆਮਦਨੀ ਰੈਗੂਲਰ ਆਮਦਨੀ ਮਤਲਬ ਸੈਲਰੀ ਫਿਕਸ ਹੁੰਦੀ ਹੈ ਤੁਹਾਨੂੰ ਪੈਨਸ਼ਨ ਮਿਲ ਸਕਦੀ ਹੈ ਪਰ ਜਦੋਂ ਬੰਦਾ ਆਪਣਾ ਕਾੜੋਬਾੜ ਕਰਦਾ ਹੈ ਤਾਂ ਉਹ ਜ਼ਿਆਦਾ ਰਿਸਕੀ ਹੁੰਦਾ ਹੈ ਅਤੇ ਉਹ 'ਚ ਲਾਭ ਵੀ ਜ਼ਿਆਦਾ ਹੀ ਹੁੰਦਾ ਉਹ 'ਚ ਪ੍ਰੋਫਿਟ ਮਤਲਬ ਉਹ 'ਚ ਲਾਭ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇੱਕ ਸਰਕਾਰੀ ਨੌਕਰੀ ਵਿੱਚ ਤੁਹਾਨੂੰ ਆਜ਼ਾਦੀ ਘੱਟ ਹੁੰਦੀ ਹੈ ਬਲਕਿ ਜਦੋਂ ਆਪਣਾ ਕਾੜੋਬਾ ਹੁੰਦਾ ਹੈ ਬੰਦਾ ਆਪਣੇ ਹਿਸਾਬ ਨਾਲ ਕੰਮ ਕਰ ਸਕਦਾ ਹੈ ਅਤੇ ਸਰਕਾਰੀ ਨੌਕਰੀ ਵਿੱਚ ਤੁਹਾਡੀ ਇੱਕ ਪੱਕੀ ਤਨਖਾਹ ਹੁੰਦੀ ਹੈ ਅਤੇ ਤੁਹਾਡੀ ਤਰੱਕੀ ਹੌਲੀ ਹੁੰਦੀ ਹੈ ਅਤੇ ਆਪਣੇ ਕਾੜੋਬਾੜ ਵਿੱਚ ਤਨਖਾਹ ਦੀ ਕੋਈ ਲਿਮਿਟ ਨਹੀਂ ਹੁੰਦੀ ਅਤੇ ਤੁਹਾਡੀ ਤਰੱਕੀ ਤੇਜ਼ ਹੁੰਦੀ ਆ ਅਗਰ ਸਰਕਾਰੀ ਨੌਕਰੀ ਦੇ ਨਾਲ ਕੰਪੇਅੜ ਕਰੀਏ ਤਾਂ ਅਗਰ ਆਪਾਂ ਰਿਸਕ ਦੇਖੀਏ ਤਾਂ ਸਰਕਾਰੀ ਨੌਕਰੀ ਵਿੱਚ ਘੱਟ ਹੁੰਦਾ ਹੈ ਸਾਨੂੰ ਗਰੰਟੀ ਹੁੰਦੀ ਨੌਕਰੀ ਦੀ ਸਾਡੀ ਪਰ ਜਦੋਂ ਆਪਾਂ ਆਪਣਾ ਕਾੜੋਬਾੜ ਕਰਦੇ ਹਾਂ ਤਾਂ ਉਹ ਜ਼ਿਆਦਾ ਹੁੰਦਾ ਹੈ ਪ੍ਰੈਸ਼ਰ ਸਾਡੇ ਨਾ ਕੰਮ ਕਰਨ ਦਾ ਬੋਝ ਸਰਕਾਰੀ ਨੌਕਰੀ 'ਚ ਘੱਟ ਹੁੰਦਾ ਕਿਉਂਕਿ ਆਪਾਂ ਉਹ ਕਿਸੇ ਹੋਰ ਦੇ ਹਿਸਾਬ ਨਾਲ ਕੰਮ ਕਰਦੇ ਹਾਂ ਪਰ ਜਦੋਂ ਆਪਾਂ ਆਪਣਾ ਕਾੜੋਬਾੜ ਕਰਦੇ ਹਾਂ ਤਾਂ ਸਾਡੇ 'ਤੇ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਕਿਉਂਕਿ ਆਪਾਂ ਆਪਣਾ ਡਿਸੀਜ਼ਨ ਆਪਾਂ ਆਪਣਾ ਫੈਸਲਾ ਆਪਾਂ ਆਪ ਕਰਨਾ ਹੁੰਦਾ ਹੈ ਮੈਂ ਤਾਂ ਜਦੋਂ ਚੁਣਦਾ ਤਾਂ ਮੈਂ ਆਪਣਾ ਕਾੜੋਬਾੜ ਹੀ ਚੁਣਦਾ ਕਿਉਂਕਿ ਮੈਂ ਮੈਂ ਆਪਣਾ ਬੰ ਮੈਂ ਆਪਣਾ ਆਪਣੇ ਆਪ ਚਲਾ ਸਕਦਾ ਸੀ ਜਿੱਦਾਂ ਕਰਨਾ ਮੈਨੂੰ ਕਿਸੇ ਦੀ ਸੁਣਨ ਦੀ ਲੋੜ ਨਹੀਂ ਮੈਂ ਆਪਣਾ ਕੰਮ ਆਪ ਕਰ ਸਕਦਾ ਮੈਨੂੰ ਇਹਦੀ ਕੋਈ ਲੋੜ ਨਹੀਂ ਕਿ ਮੈਨੂੰ ਛੁੱਟੀ ਕਰਨੀ ਮੈਂ ਜਦੋਂ ਚਾਹਾਂ ਕੰਮ ਕਰ ਸਕਦਾ ਨਹੀਂ ਕਰ ਸਕਦਾ ਇਹ 'ਚ ਮੇਰੀ ਆਪਣੀ ਮਰਜ਼ੀ 'ਤੇ ਹੱਕ ਹੋਵੇਗਾ ਅਤੇ ਇਹਦੇ 'ਚ ਮੇਰੀ ਕੋਈ ਸੈਲਰੀ ਮੈਨੂੰ ਜਦੋਂ ਮਰਜ਼ੀ ਗਰੋਥ ਹੋ ਸਕਦੀ ਹੈ ਅਤੇ ਮੈਂ ਨਵੇਂ ਨਵੇਂ ਆਈਡੀਆ ਲੈ ਕੇ ਆ ਸਕਦਾ ਹਾਂ ਅਤੇ ਮੈਂ ਤਾਂ ਸਰਕਾਰੀ ਮੈਂ ਤਾਂ ਸਰਕਾਰੀ ਨੌਕਰੀ ਜਗ੍ਹਾ ਆਪਣਾ ਕਾੜੋਬਾੜ ਹੀ ਚੁਣਦਾ ਸਹੀ ਸਹੀ ਲੱਗੂਗਾ